ਸਰਕਾਰਾਂ ਨੇ ਨੌਜਵਾਨਾਂ ਲਈ ਰੋਜ਼ਗਾਰ ਸਹੂਲਤਾਂ ਲਈ ਬਹੁਤ ਸਾਰੇ ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਵੇਂ ਕਿ ਆਤਮ ਨਿਰਭਰ ਯੋਜਨਾ ਜਿਵੇਂ ਕਿ ਜਦੋਂ ਲੋਕੀ ਆਪਣੇ ਆਪ ਵਿੱਚ ਹੋ ਜਾਣਗੇ ਆਪ ਜੇ ਕੁਛ ਕਰ ਸਕਣਗੇ ਫਿਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਰਾਸ਼ਟਰ ਕਰੀਅਰ ਸੇਵਾ ਰਾਸ਼ਟਰੀ ਗ੍ਰਾਮੀਨ ਆਜੀਵਿਕਾ ਮਿਸ਼ਨ ਡਿਜੀਟਲ ਇੰਡੀਆ ਮੇਕ ਇਨ ਇੰਡੀਆ ਸਮਾਰਟ ਸ਼ਹਿਰ ਸਮਾਰਟ ਸ਼ਹਿਰ ਨਾਲ ਹਰ ਸ਼ਹਿਰ ਦੇ ਵਿੱਚ ਸਮਾਰਟ ਓ ਮੈਟਰੋ ਖੁੱਲੇਗੀ ਸਮਾਰਟ ਸ਼ਹਿਰ ਬਨਣਗੇ ਸਾਡਾ ਭਾਰਤ ਵੀ ਬਹੁਤ ਅੱਗੇ ਵੱਧ ਜਾਏਗਾ ਜਿਸ ਵਿੱਚ ਫਿਰ ਸਟੈਂਡ ਅਪ ਇੰਡੀਆ ਜਿਸ ਵਿੱਚ ਲੋਕਾਂ ਨੂੰ ਸਹੀ ਤਰ੍ਹਾਂ ਨਾਲ ਦੱਸਿਆ ਜਾਏਗਾ ਕਿ ਕਿੱਦਾਂ ਅਸੀਂ ਆਪਣੇ ਦੇਸ਼ ਨੂੰ ਅੱਗੇ ਵਧਾ ਸਕਦੇ ਹਾਂ ਜਿਵੇਂ ਕਿ ਜਪਾਨ ਬਹੁਤ ਜ਼ਿਆਦਾ ਅੱਗੇ ਵੱਧ ਚੁੱਕਾ ਹੈ ਜੇ ਅਸੀਂ ਵੀ ਇਹ ਸਾਰੀਆਂ ਚੀਜ਼ਾਂ ਕਰਾਂਗੇ ਉਹਦੇ ਨਾਲ ਸਾਡਾ ਵੀ ਦੇਸ਼ ਸਾਡਾ ਵੀ ਭਾਰਤ ਬਹੁਤ ਅੱਗੇ ਵੱਧ ਜਾਏਗਾ ਦੁਨੀਆਂ ਵਿੱਚ ਜਿਵੇਂ ਕਿ ਹੁਣ ਸਵੱਛ ਭਾਰਤ ਜੇ ਸਾਡਾ ਭਾਰਤ ਸਵੱਛ ਹੋਏਗਾ ਤਾਂ ਹੀ ਬਾਹਰ ਦੇ ਲੋਕੀ ਕੋਈ ਵੀ ਆਏਗਾ ਤਾਂ ਉਹਨਾਂ ਨੂੰ ਵਧੀਆ ਲੱਗੇਗਾ ਇੱਥੇ ਆ ਕੇ ਨਹੀਂ ਤਾਂ ਉਹ ਸਾਰੇ ਕਹਿਣਗੇ ਕਿ ਸਾਡਾ ਗਰੀਬ ਦੇਸ਼ ਹੈ ਜੋ ਕਿ ਜੇ ਅਸੀਂ ਆਪਣੇ ਦੇਸ਼ ਨੂੰ ਸਾਫ ਰੱਖਾਂਗੇ ਤਾਂ ਫਿਰ ਕੋਈ ਵੀ ਇੱਦਾਂ ਸਾਨੂੰ ਆ ਕੇ ਨਹੀਂ ਕਹਿ ਸਕੇਗਾ